ਹਾਂ ਬਾਗਬਾਨੀ ਬਾਗਬਾਨੀ ਤਾਂ ਅਸੀਂ ਬਹੁਤ ਟਾਈਮ ਤੋਂ ਸ਼ੁਰੂ ਕੀਤੀ ਹੈ ਸਾਡੇ ਸਾਹਮਣੇ ਇੱਕ ਪਲਾਟ ਖਾਲੀ ਪਿਆ ਸੀ ਪਹਿਲਾਂ ਅਸੀਂ ਉਹ ਖਰੀਦਿਆ ਫਿਰ ਉਹਦੇ ਵਿੱਚ ਅਸੀਂ ਚਾਰ ਬਾਈ ਕੀਤੀ ਚਾਰ ਬਾਈ ਕਰਕੇ ਉਹਦੇ 'ਚ ਅਸੀਂ ਥੋੜ੍ਹੀ ਜਿਹੀ ਭਰਤ ਪਵਾਈ ਭਰਤ ਪਵਾ ਕੇ ਉਹਨੂੰ ਫਿਰ ਥੋੜ੍ਹਾ ਜਿਹਾ ਉੱਚਾ ਕੀਤਾ ਚਾਰੇ ਪਾਸੇ ਕੰਨਾ ਕੱਢ ਕੇ ਉਹਦੇ ਵਿੱਚ ਅਸੀਂ ਫੁੱਲ ਬੂਟੇ ਪੌਦੇ ਸਾਰਾ ਕੁਛ ਉਹਦੇ ਵਿੱਚ ਉਗਾਇਆ ਸਬਜ਼ੀਆਂ ਸੁਬਜ਼ੀਆਂ ਜਿਵੇਂ ਅੱਜ ਕੱਲ੍ਹ ਸਪਰੇਅ ਵਾਲੀਆਂ ਮਿਲਦੀਆਂ ਏ ਬਾਜ਼ਾਰ 'ਚੋਂ ਲਈਏ ਤਾਂ ਅਸੀਂ ਉਹਦੇ ਵਿੱਚ ਸਬਜ਼ੀਆਂ ਵੀ ਬੀਜੀਆਂ ਪਿਆਜ ਬੀਜੇ ਆਲੂ ਗੋਬੀ ਕੱਦੂ ਤੋਰੀਆਂ ਮਤਲਬ ਸਭ ਕੁਛ ਅਸੀਂ ਘਰ ਬੀਜਿਆ ਹੋਇਆ ਏ ਉਹਦੇ ਵਿੱਚ ਇੱਕ ਅਸੀਂ ਝੂਲਾ ਲਾਇਆ ਬਾਗਬਾਨੀ ਵਿੱਚ ਜਿਹਦੇ 'ਤੇ ਬੱਚੇ ਸਾਡੇ ਝੂਟੇ ਲੈਂਦੇ ਆ ਆਨੰਦ ਮਾਣਦੇ ਆ ਅਨੰਦ ਮਾਣਦੇ ਆ ਅਤੇ ਫਿਰ ਅਸੀਂ ਉਹਦੇ ਵਿੱਚ ਜਿਹੜੀਆਂ ਸਬਜ਼ੀਆਂ ਸੁਬਜ਼ੀਆਂ ਲਾਈਆਂ ਹੋਈਆਂ ਨੇ ਬਹੁਤ ਮਤਲਬ ਕੀਟਾਣੂ ਰਹਿਤ ਹੈ ਸਾਰੀਆਂ ਉਹਨਾਂ 'ਚ ਕੋਈ ਕੋਈ ਸਪਰੇਅ ਵਗੈਰਾ ਨਹੀਂ ਕੋਈ ਕੁਛ ਨਹੀਂ ਹੈਗਾ ਉਹ ਸਬਜ਼ੀਆਂ ਅਸੀਂ ਘਰ ਬਣਾਉਂਦੇ ਹਾਂ ਤਾਂ ਬਹੁਤ ਸਵਾਦ ਬਣਦੀਆਂ ਏ ਕਿਉਂਕਿ ਉਹ ਘਰ ਦੀਆਂ ਬੀਜੀਆਂ ਸਬਜ਼ੀਆਂ ਉਹਨੂੰ ਚੰਗਾ ਪਾਣੀ ਦਿੱਤਾ ਜਾਂਦਾ ਏ ਚੰਗੀ ਖਾਦ ਪਾਈ ਜਾਂਦੀ ਹੈ ਜੋ ਵੀ ਸਬਜ਼ੀਆਂ ਲੱਗੀਆਂ ਫਲ ਪੌਦੇ ਇੰਨੇ ਲੱਗੇ ਹੋਏ ਆ ਪੁੱਛੋ ਹੀ ਨਾ ਅਤੇ ਅਸੀਂ ਆਪਦੇ ਜੋ ਵੀ ਸਬਜ਼ੀਆਂ ਬੀਜਦੇ ਹਾਂ ਆਸ ਪੜੋਸ ਜਾ ਜੋ ਵੀ ਆਉਂਦਾ ਉਹਨੂੰ ਦੇ ਦਿੰਦੇ ਹਾਂ ਉਹ ਵੀ ਸਬਜ਼ੀਆਂ ਬਣਾ ਕੇ ਬਹੁਤ ਖੁਸ਼ ਹੁੰਦੇ ਆ ਲੋਕ ਵੀ ਤਾਂ ਬ ਕੀਟਾਣੂ ਰਹਿਤ ਹੈ ਅਤੇ ਸਬਜ਼ੀ ਬਹੁਤ ਸਵਾਦ ਬਣਦੀ ਹੈ ਇਸ ਲਈ ਅਸੀਂ ਪੁਦੀਨਾ ਵਗੈਰਾ ਅਤੇ ਆਹ ਧਨੀਆ ਵਗੈਰਾ ਘਰ ਬੀਜਿਆ ਵਿਆ ਏ ਉਹ ਵੀ ਇੰਨੇ ਫੁੱਲ ਪੌਦੇ ਬਹੁਤ ਬੂਝੇ ਹੋਏ ਆ